ਜਿਵੇਂ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਮਸ਼ਹੂਰ ਨੇ ਗੁੱਲੀ ਡੰਡਾ ਖੋ ਖੋ ਕਬੱਡੀ ਹਾਕੀ ਕ੍ਰਿਕਟ ਆਦਿ ਪਰ ਮੇਰੀ ਆਪਣੀ ਮਨਪਸੰਦ ਖੇਡ ਕ੍ਰਿਕਟ ਹੈ ਕਿਉਂਕਿ ਇਹ ਮੈਨੂੰ ਬਚਪਨ ਤੋਂ ਹੀ ਬਹੁਤ ਪਸੰਦ ਅਤੇ ਮੈਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ ਬਚਪਨ ਵਿੱਚ ਜਦੋਂ ਮੈਂ ਆਪਣੇ ਭਰਾਵਾਂ ਨੂੰ ਕ੍ਰਿਕਟ ਖੇਡਦੇ ਦੇਖਦੀ ਸੀ ਤਾਂ ਮੇਰਾ ਵੀ ਕ੍ਰਿਕਟ ਖੇਡਣ ਦਾ ਮਨ ਕਰਦਾ ਸੀ ਫਿਰ ਮੈਂ ਆਪਣੇ ਭਰਾਵਾਂ ਦੇ ਨਾਲ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਮੈਨੂੰ ਬੈਟਿੰਗ ਕਰਨ ਦਾ ਬਹੁਤ ਸ਼ੌਂਕ ਸੀ ਔਰ ਮੈਨੂੰ ਬੈਟਿੰਗ ਕਰਨੀ ਬਹੁਤ ਹੀ ਪਸੰਦ ਸੀ ਅਸੀਂ ਅਕਸਰ ਹੀ ਗਲੀ ਦੇ ਵਿੱਚ ਕ੍ਰਿਕਟ ਖੇਡਦੇ ਸੀ ਅਸੀਂ ਆਪਣੀਆਂ ਟੀਮਾਂ ਬਣਾ ਲੈਂਦੇ ਸੀ ਮੈਂ ਆਪਣੀ ਟੀਮ ਨੂੰ ਕਈ ਵਾਰ ਇੱਕ ਚੰਗੀ ਸਕੋਰ ਬਣਾ ਕੇ ਜਿਤਾਇਆ ਸੀ ਫਿਰ ਹੌਲੀ ਹੌਲੀ ਮੇਰਾ ਕ੍ਰਿਕਟ ਵਿੱਚ ਰੁਝਾਨ ਵੱਧਦਾ ਗਿਆ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਗੇਮਜ਼ ਵਿੱਚ ਜਾਣਾ ਚਾਹੁੰਦੀ ਹਾਂ ਅਤੇ ਮੈਂ ਕ੍ਰਿਕਟ ਖੇਡਣਾ ਚਾਹੁੰਦੀ ਹਾਂ ਉਹਨਾਂ ਨੇ ਵੀ ਮੇਰੀ ਕ੍ਰਿਕਟ ਪ੍ਰਤੀ ਲਗਾਅ ਨੂੰ ਦੇਖਦੇ ਹੋਏ ਮੈਨੂੰ ਕ੍ਰਿਕਟ ਦੀ ਗੇਮ ਰੱਖਣ ਲਈ ਪ੍ਰੇਰਿਤ ਕੀਤਾ ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲ ਵਿੱਚ ਕ੍ਰਿਕਟ ਖੇਡੀ ਸਾਡਾ ਸਕੂਲ ਹੋਰਾਂ ਸਕੂਲਾਂ ਨਾਲ ਮੁਕਾਬਲਾ ਕਰਨ ਜਾਂਦਾ ਸੀ ਅਤੇ ਕਈ ਵਾਰ ਅਸੀਂ ਆਪਣੀ ਟੀਮ ਨੂੰ ਜਿਤਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਮੇਰੇ ਪਿਤਾ ਮੇਰੇ ਮਾਤਾ ਪਿਤਾ ਵੀ ਮੇਰੀਆਂ ਜਿੱਤਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ ਫਿਰ ਮੈਂ ਕੋਲਜ ਗਈ ਤਾਂ ਉੱਥੇ ਵੀ ਮੈਂ ਗੇਮਜ਼ ਦੇ ਵਿੱਚ ਕ੍ਰਿਕਟ ਨੂੰ ਹੀ ਚੁਣਿਆ ਕੋਲਜ ਤੋਂ ਹੀ ਅਸੀਂ ਕਾਫ਼ੀ ਸਟੇਟਸ ਦੇ ਵਿੱਚ ਕ੍ਰਿਕਟ ਖੇਡਣ ਜਾਂਦੇ ਰਹੇ ਅਤੇ ਕਈ ਪ੍ਰਾਈਜ਼ ਜਿੱਤ ਕੇ ਲਿਆਉਂਦੇ ਸੀ ਮੈਂ ਆਪਣੀ ਇਸ ਗੇਮ ਨੂੰ ਇੰਟਰਨੈਸ਼ਨਲ ਲੈਵਲ ਤੱਕ ਲਿਜਾਉਣਾ ਚਾਹੁੰਦੀ ਸੀ ਪਰ ਕੁਝ ਮਜਬੂਰੀਆਂ ਅਤੇ ਹਾਲਾਤਾਂ ਦੇ ਕਾਰਨ ਮੈਂ ਅੱਗੇ ਹੋਰ ਕ੍ਰਿਕਟ ਨਹੀਂ ਖੇਡ ਸਕੀ ਪਰ ਕ੍ਰਿਕਟ ਮੇਰੀ ਅੱਜ ਵੀ ਬਹੁਤ ਹੀ ਮਨਪਸੰਦ ਖੇਡ ਹੈ ਮੈਂ ਅੱਜ ਵੀ ਇੰਡੀਆ ਦੇ ਮੈਚ ਬਹੁਤ ਸ਼ੌਕ ਨਾਲ ਦੇਖਦੀ ਹਾਂ ਧੰਨਵਾਦ